ਹੈਲੋ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਪੁੱਛੋ

ਓਕੇ ਓਕੇ ਮੈਮ ਹਾਂਜੀ ਮੈਮ ਹਾਂਜੀ ਮੈਮ ਅਸੀਂ ਦੱਸ ਸਕਦੇ ਹਾਂ ਜੀ ਮੈਮ ਆਪ ਗੌਰਮੈਂਟ ਕੋਲਿਜ 'ਚ ਕਰਨਾ ਜਾਂ ਫਿਰ ਪ੍ਰਾਈਵੇਟ 'ਚ ਮੈਮ ਗੌਰਮੈਂਟ ਕੋਲਿਜ ਤੁਹਾਨੂੰ ਇੱਥੇ ਛੇ ਫੇਸ ਮੋਹਾਲੀ 'ਚ ਮਿਲੇਗਾ ਉੱਥੇ ਮੈਮ ਤੁਹਾਨੂੰ ਵਧੀਆ ਉੱਥੇ ਟੀਚਰਸ ਨੇ ਅਤੇ ਬੀ ਸੀ ਏ ਦੀ ਇੱਥੇ ਤੁਹਾਨੂੰ ਮਿਲੇਗੀ ਸਭ ਉੱਥੇ ਸਭ ਵਧੀਆ ਟੀਚਰਸ ਨੇ ਅਤੇ ਉੱਥੇ ਉੱਥੇ ਮੈਮ ਇਵੇਂ ਸਮੈਸਟਰ ਵਾਈਜ਼ ਦੇ ਹੁੰਦੀ ਆ ਫਸਟ ਸਮੈਸਟਰ 'ਚ ਤੁਹਾਡੀ ਵੀਹ ਹਜ਼ਾਰ ਦੇ ਕਰੀਬ ਹੋਵੇਗੀ ਅਤੇ ਉਹ ਤੋਂ ਬਾਅਦ ਅਗਲੇ ਸਮੈਸਟਰ ਦੀ ਅਲੱਗ ਤੋਂ ਹੋਵੇਗੀ ਹਾਂਜੀ ਮੈਮ ਹੋਰ ਮੈਮ ਕੋਲਿਜ ਤੁਹਾਨੂੰ ਇੱਧਰ ਮਿਲ ਜਾਣਗੇ ਜੀ ਇੱਥੇ ਲਾਂਡਰਾਂ ਸਾਈਡ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਤੁਹਾਨੂੰ ਉੱਥੇ ਐੱਨ ਸੀ ਸੀ ਹੈਗੀ ਹੈ ਉੱਥੇ ਐੱਨ ਸੀ ਸੀ ਦੋ ਵਿੰਗ ਨੇ ਉੱਥੇ ਆਰਮੀ ਵਿੰਗ ਅਤੇ ਨੇਵੀ ਵਿੰਗ ਦਾ ਤੁਸੀਂ ਮੈਮ ਜਿਹੜੇ 'ਚ ਕਰਨਾ ਹੁੰਦਾ ਉੱਥੇ ਆਰਮੀ ਵਿੰਗ ਜਾਂ ਨੇਵੀ ਵਿੰਗ ਤਾਂ ਤੁਸੀਂ ਕਰਵਾ ਸਕਦੇ ਹੋ ਅਤੇ ਤੁਹਾਡੇ ਇੱਥੇ ਆਹ ਰੋਪੜ ਰਿਕੁਆਇਰਮੈਂਟ ਹੁੰਦੀ ਹੈ ਰੋਪੜੋ ਆਉਂਦੇ ਨੇ ਸਰ ਅਤੇ ਉੱਥੋਂ ਤੁਹਾਡੀ ਇੱਥੇ ਰਿਕੁਆਇਰਮੈਂਟ ਹੁੰਦੀ ਹੈ ਤੁਹਾਡਾ ਟੈਸਟ ਹੋਵੇਗਾ ਉਸ ਦੇ ਵਿੱਚ ਇੱਕ ਐੱਨ ਸੀ ਸੀ ਬੇਸਿਕ ਕੁਸ਼ਚਨਸ ਆਉਣਗੇ ਉਹਦੇ 'ਚ ਅਤੇ ਤੁਹਾਡੇ ਉੱਥੇ ਫਿਜੀਕਲ ਵੀ ਫਿਟ ਹੋਣੇ ਚਾਹੀਦੇ ਹੋ ਤੁਸੀਂ ਇਸ ਕਰਕੇ ਤੁਹਾਡੀ ਰਿਕੁਆਇਰਮੈਂਟ ਉੱਥੇ ਰੱਖੀ ਜਾਵੇਗੀ ਹਾਂਜੀ ਮੈਮ ਹਾਂਜੀ ਤੁਹਾਡੇ ਕੋਲ ਏ ਸਰਟੀਫਿਕੇਟ ਹੋਣਾ ਉੱਧਰੋਂ ਸਕੂਲ ਕੋਲੋਂ ਹਾਂਜੀ ਮੈਮ ਫਿਰ ਤੁਹਾਡਾ ਏ ਸਰਟੀਫਿਕੇਟ ਤੁਹਾਡੇ ਵਾਸਤੇ ਬੈਨੀਫਿਸ਼ਅਲ ਹੈ ਕਿਉਂਕਿ ਥ ਏ ਸਰਟੀਫਿਕੇਟ ਨੂੰ ਜ਼ਿਆਦਾ ਇੱਥੇ ਮਹੱਤਵਪੂਰਨ ਮਹੱਤਤਾ ਮਿਲਦੀ ਹੈ ਕਿਉਂਕਿ ਬਾਕੀਆਂ ਨਾਲੋਂ ਏ ਸਰਟੀਫਿਕੇਟ ਤੁਹਾਡੇ ਕੋਲ ਹੈਗਾ ਹੈ ਬਾਕੀ ਬੱਚਿਆਂ ਕੋਲ ਏ ਸਰਟੀਫਿਕੇਟ ਨਹੀਂ ਹੋਏਗਾ ਤੁਹਾਡੇ ਫਸਟ ਈਅਰ 'ਚ ਕੁਛ ਵੀ ਨਹੀਂ ਹੋਵੇਗਾ ਸੈਕਿੰਡ ਈਅਰ 'ਚ ਮੈਮ ਤੁਹਾਡਾ ਬੀ ਦਾ ਪੇਪਰ ਹੋਵੇਗਾ ਅਤੇ ਤੁਹਾਡਾ ਥਰਡ ਈਅਰ 'ਚ ਸੀ ਦਾ ਪੇਪਰ ਹੋਵੇਗਾ ਹਾਂਜੀ ਹਾਂਜੀ ਥੈਂਕ ਯੂ